ਹਾਂ ਮੈਂ ਬਹੁਤ ਵਧੀਆ ਅਨੁਭਵ ਸਾਂਝਾ ਕਰ ਰਹੀ ਹਾਂ ਤੁਹਾਡੇ ਨਾਲ ਮੈਂ ਯੋਗਾ ਦਾ ਕੈਂਪ ਜੁਆਇਨ ਕੀਤਾ ਸੀ ਅ ਸਾਡੇ ਮੁਹੱਲੇ ਦੇ ਵਿੱਚ ਕੈਂਪ ਲੱਗਾ ਸੀ ਅਸੀਂ ਮੈਂ ਸਵੇਰੇ ਉੱਠ ਕੇ ਸਵੇਰੇ ਸਵੇਰੇ ਚਾਰ ਵਜੇ ਉੱਠ ਕੇ ਆਪਣੇ ਆਪ ਕੈਂਪ ਦੇ ਵਿੱਚ ਜਾਈਦਾ ਸੀਗਾ ਅਤੇ ਉੱਥੇ ਆਪਾਂ ਸਾਰੀ ਤੁਹਾਨੂੰ ਯੋਗ ਕਿਰਿਆਵਾਂ ਕਰਵਾਉਂਦੇ ਸੀਗੇ ਮੇਰੇ ਮੈਨੂੰ ਬਹੁਤ ਜ਼ਿਆਦਾ ਮੇਰਾ ਸਿਰ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਅਤੇ ਮੈਂ ਅਤੇ ਸਟਰੈਸ ਜਿਵੇਂ ਮੇਰਾ ਬਹੁਤ ਜ਼ਿਆਦਾ ਸੀਗਾ ਮੈਨੂੰ ਕੋਈ ਗੱਲ ਕਹਿ ਦਿੰਦਾ ਸੀ ਕਿ ਮੇਰੇ ਦਿਮਾਗ 'ਤੇ ਬੈਠ ਜਾਂਦੀ ਸੀਗੀ ਅਤੇ ਮੈਂ ਫਿਰ ਉਹ ਜੁਆਇਨ ਜਿੱਦਾਂ ਹੀ ਉਹ ਮੈਂ ਅਨੁਲੋਮ ਵਿਲੋਮ ਅਤੇ ਉਹਨਾਂ ਨੇ ਸਾਨੂੰ ਜਿਹੜੇ ਵੀ ਅਭਿਆਸ ਕਰਵਾਏ ਅਨੁਲੋਮ ਵਿਲੋਮ ਹੋਰ ਡੀਪ ਬਰੀਥਿੰਗ ਵਗੈਰਾ ਕਰਵਾਈ ਸਾਨੂੰ ਉਹਨਾਂ ਨੇ ਅਤੇ ਉਹਦੇ ਨਾਲ ਮੇਰਾ ਬੀ ਪੀ ਦੀ ਪ੍ਰੋਬਲਮ ਸੀ ਉਹ ਵੀ ਠੀਕ ਹੋਈ ਸਟਰੈਸ ਲੇਵਲ ਹੀ ਬਹੁਤ ਜ਼ਿਆਦਾ ਘਟਿਆ ਅਤੇ ਉਹ ਜੀ ਉਹ ਜਾ ਉਹ ਕੈਂਪ ਨੂੰ ਜੁਆਇਨ ਕਰਨ ਤੋਂ ਬਾਅਦ ਹੀ ਮੇਰਾ ਸਭ ਸ਼ਰੀਰਿਕ ਅਤੇ ਮਾਨਸਿਕ ਕਿ ਸਿਹਤ ਬਿਲਕੁਲ ਇੱਕ ਤਰ੍ਹਾਂ ਇੱਕ ਇੱਕਦਮ ਬਹੁਤ ਵਧੀਆ ਹੋ ਗਈ ਅਤੇ ਯੋਗਾ ਸਾਡੇ ਵਾਸਤੇ ਬਹੁਤ ਹੀ ਫ਼ਾਇਦੇਮੰਦ ਹੈਗਾ ਤਾਂ ਇਸ ਵਾਸਤੇ ਸਾਨੂੰ ਅਨੁਲੋਮ ਵਿਲੋਮ ਬਰੰਮ ਬਰਾਮੇ ਉਜੈਨੀ ਥਾਏਰੈਡ ਦੀ ਪ੍ਰੋਬਲਮ ਲਈ ਉਜੈਨੀ ਪਰਾਣਾਯਾਮ ਬਹੁਤ ਹੀ ਫ਼ਾਇਦੇਮੰਦ ਹੈ ਅਤੇ ਇਹ ਯੋਗਾ ਕਰਨ ਦੇ ਨਾਲ ਸਾਡੇ ਸਰੀਰ ਨੂੰ ਮਾਨਸਿਕ ਅਤੇ ਅਤੇ ਸਰੀਰਿਕ ਸਾਰੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਇਹ ਕਰਨ ਦੇ ਨਾਲ ਹੀ ਸਾਡਾ ਮੇਰਾ ਸਰੀਰ ਇਕਦਮ ਠੀਕ ਹੋ ਗਿਆ ਕਿਉਂਕਿ ਅਸੀਂ ਨੂੰ ਮੈਂ ਸੱਤ ਦਿਨ ਰੈਗੂਲਰ ਪੂਰਾ ਜੁਆਇਨ ਕੀਤਾ ਸਵੇਰੇ ਚਾਰ ਵਜੇ ਉੱਠ ਕੇ ਜਾਣਾ ਜਾਂਦੀ ਸੀਗੀ ਅਤੇ ਫਿਰ ਉਹਨੂੰ ਆਪਣਾ ਸਾਰਾ ਹੀ ਦੋ ਦੋ ਘੰਟੇ ਦੇ ਯੋਗਾ ਦੇ ਵਿੱਚ ਮੈਨੂੰ ਬਹੁਤ ਹੀ ਬਹੁਤ ਵਧੀਆ ਪ੍ਰਣਾਮ ਮਿਲੇ ਜਿਸ ਨਾਲ ਮੇਰੀ ਸਿਹਤ ਬਹੁਤ ਵਧੀਆ ਹੋ ਗਈ